ਮੈਂ ਪਿਛਲੇ ਸਾਲ ਹੀ ਗੁਜਰਾਤ ਘੁੰਮਣ ਲਈ ਗਿਆ ਸੀ ਉੱਥੇ ਬਹੁਤ ਹੀ ਕੁਝ ਦੇਖਣ ਅਤੇ ਸਿੱਖਣ ਲਈ ਹੈ ਜਦੋਂ ਗੁਜਰਾਤ ਵਿੱਚ ਅਸੀਂ ਇੱਕ ਨੈਸ਼ਨਲ ਪਾਰਕ ਬਾਰੇ ਸੁਣਿਆ ਤਾਂ ਮੈਂ ਉਸ ਚੀਜ਼ ਨੂੰ ਲੈ ਕੇ ਬਹੁਤ ਹੀ ਉਤਸੁਕ ਹੋਇਆ ਕਿ ਮੈਂ ਵੀ ਨੈਸ਼ਨਲ ਪਾਰਕ ਘੁੰਮਣ ਜਾਣਾ ਹੈ ਜਦੋਂ ਮੈਂ ਨੈਸ਼ਨਲ ਪਾਰਕ ਗਿਆ ਤਾਂ ਉੱਥੇ ਬਹੁਤ ਹੀ ਤਰ੍ਹਾਂ ਦੇ ਜਾਨਵਰ ਦਰੱਖ਼ਤ ਮੌਜੂਦ ਸਨ ਜੋ ਕਿ ਸਾਡੀ ਸੋਚ ਅਤੇ ਸਮਝ ਤੋਂ ਪਰ੍ਹੇ ਸਨ ਵੀ ਇਹ ਕਿਸ ਹਿਸਾਬ ਨਾਲ਼ ਨੈਸ਼ਨਲ ਪਾਰਕ ਬਣਾਈ ਗਈ ਹੈ ਉਸਦਾ ਏਰੀਆ ਹੀ ਇੰਨ੍ਹਾਂ ਜ਼ਿਆਦਾ ਸੀ ਜਿਸ ਵਿੱਚ ਪੂਰੇ ਦਾ ਪੂਰਾ ਇੱਕ ਸ਼ਹਿਰ ਸਮਾ ਸਕੇ ਜਦੋਂ ਅਸੀਂ ਨੈਸ਼ਨਲ ਪਾਰਕ ਦੀ ਟਿਕਟ ਲਈ ਤਾਂ ਉਹਨਾਂ ਨੇ ਸਾਡੇ ਕੱਪੜੇ ਅਤੇ ਸਾਡੀਆਂ ਚੀਜ਼ਾਂ ਉੱਥੇ ਹੀ ਰੱਖਵਾ ਲਈਆਂ ਅਤੇ ਆਪਣੇ ਵੱਲੋਂ ਦਿੱਤੇ ਗਏ ਕੱਪੜੇ ਪਵਾ ਦਿੱਤੇ ਗਏ ਉਹ ਪਹਿਨ ਕੇ ਅਸੀਂ ਨੈਸ਼ਨਲ ਪਾਰਕ ਵਿੱਚ ਐਂਟਰ ਕਰੇ ਜਦੋਂ ਅਸੀਂ ਨੈਸ਼ਨਲ ਪਾਰਕ ਵਿੱਚ ਗਏ ਤਾਂ ਉੱਥੇ ਅਸੀਂ ਸਭ ਤੋਂ ਪਹਿਲਾਂ ਸ਼ਾਕਾਹਾਰੀ ਜੀਵ ਦੇਖੇ ਜਿਨ੍ਹਾਂ ਵਿੱਚੋਂ ਬਹੁਤ ਹੀ ਸੋਹਣੇ ਹਿਰਨ ਅਤੇ ਬੋ